ਵੈਸੇ ਤਾਂ ਮੈਂ ਜਿਹੜੇ ਇਲਾਕੇ 'ਚ ਰਹਿੰਦੀ ਹਾਂ ਉੱਥੇ ਕਾਫੀ ਸਾਰੇ ਸਕੂਲ ਹਨ ਗੋਰਮੈਂਟ ਵੀ ਆ ਅਤੇ ਪ੍ਰਾਈਵੇਟ ਸਕੂਲ ਵੀ ਆ ਪਰ ਇੱਥੋਂ ਦੇ ਕੁਛ ਪ੍ਰਸਿੱਧ ਸਕੂਲ ਹਨ ਜਿੰ ਜਿਹੜਾ ਕਿ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਦੀ ਹਾਂ ਉਹਨਾਂ ਬਾਰੇ ਦੱਸ ਸਕਦੀ ਹਾਂ ਸਾਡੇ ਇਲਾਕੇ 'ਚ ਇੱਕ ਸਕੂਲ ਹੈਗਾ ਵਾ ਡੀ ਏ ਵੀ ਪਬਲਿਕ ਸਕੂਲ ਰਿਆਨ ਇੰਟਰਨੈਸ਼ਨਲ ਏ ਪੀ ਐੱਸ ਅੰਮ੍ਰਿਤਸਰ ਪਬਲਿਕ ਸਕੂਲ ਜੀ ਡੀ ਗੋਇੰਨਕਾ ਇਹ ਸਾਰੇ ਸਕੂਲ ਬਹੁਤ ਵਧੀਆ ਹਨ ਅਤੇ ਇਹਨਾਂ ਵਿੱਚੋਂ ਇੱਕ ਸਕੂਲ ਹੈਗਾ ਵਾ ਜਿਹਦੇ 'ਚ ਮੈਂ ਖੁਦ ਵੀ ਪੜ੍ਹੀ ਹੋਈ ਹਾਂ ਅਤੇ ਇੱਥੋਂ ਦੀ ਵਿਸ਼ੇਸ਼ਤਾ ਹੈ ਹੈਗੀ ਆ ਕਿ ਜਿਹੜੇ ਅੱਜ ਕੱਲ੍ਹ ਦੇ ਮਾਹੌਲ ਦੇ ਹਿਸਾਬ ਨਾਲ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੇ ਸਨ ਅਤੇ ਸਾਡੀ ਜਿਹੜੀ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ ਕਿਉਂਕਿ ਇਹ ਸਕੂਲ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਐਕਸਟਰਾ ਐਕਟੀਵਿਟੀਸ ਜਿਹੜੀਆਂ ਹੁੰਦੀਆਂ ਵਾ ਮਿਊਜ਼ਿਕ ਸਿੰਗਿੰਗ ਡਾਂਸਿੰਗ ਕੋਂਪੀਟੀਸ਼ਨ ਹੁੰਦੇ ਹਨ ਪੇਂਟਿੰਗ ਵੀ ਸਿਖਾਈ ਜਾਂਦੀ ਹੈ ਅਤੇ ਬੱਚਿਆਂ ਦੀ ਪੜ੍ਹਾਈ ਵੀ ਜਿਹੜੀ ਮੋਡਰਨ ਤਰੀਕੇ ਨਾਲ ਹੁੰਦੀ ਹੈ ਸਮਾਰਟ ਕਲਾਸਿਸ ਦੇ ਥਰੂ ਕਰਵਾਏ ਜਾਂਦੇ ਹਨ ਅਤੇ ਪੂਰਾ ਜਿਹੜਾ ਕਿ ਸਾਨੂੰ ਨੌਲੇਜ ਵੀ ਮਿਲਦੀ ਹੈ ਵੈਸੇ ਤਾਂ ਮੈਂ ਇਹਨਾਂ ਦੀ ਗੁਣਵੱਤਾ ਤੋਂ ਸੰਤੁਸ਼ਟ ਹੈਗੀ ਹਾਂ ਕਿ ਬਹੁਤ ਵਧੀਆ ਸਿੱਖਿਆ ਪ੍ਰੋਵਾਈਡ ਕਰਦੇ ਆ ਅਤੇ ਵੱਡੇ ਸ਼ਹਿਰਾਂ ਦੇ ਸਕੂਲ ਦੇ ਮੁਤਾਬਕ ਸਾਨੂੰ ਜਿਹੜੀ ਆ ਉਹ ਸਿੱਖਿਆ ਪ੍ਰਦਾਨ ਕਰਦੇ ਹਨ ਅਤੇ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ ਅਤੇ ਜੋ ਵੀ ਆ ਸਾਰਾ ਉਸ ਹਿਸਾਬ ਨਾਲ ਹੀ ਪ੍ਰੋਵਾਈਡ ਕਰਦੇ ਨੇ ਸਾਨੂੰ